ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਠੀਕ ਹੈ ਜੀ ਹਾਂ ਤੁਸੀਂ ਕਿੱਥੋਂ ਬੋਲਦੇ ਹੋ ਜੀ ਤੁਸੀਂ ਹਰਮਨ ਟੇਲਰ ਬੋਲਦੇ ਹੋ ਜੀ ਮੈਮ ਸੂਟ ਦੀ ਸਿਲਾਈ ਕਿੰਨੀ ਹੈ ਸੂਟ ਮੈਂ ਲੈਸਾਂ ਲਾ ਕੇ ਸਵਾਉਣਾ ਹੈ ਜੀ ਹਾਂਜੀ ਲੈਨਿੰਗ ਵੀ ਲਵਾਉਣੀ ਹੈ ਜੀ ਚਲੋ ਠੀਕ ਹੈ ਜੀ ਤੁਸੀਂ ਕਦੋਂ ਤੱਕ ਦੇ ਸਕਦੇ ਹੈ ਅੱਛਾ ਜੀ ਠੀਕ ਹੈ ਜੀ ਨਾ ਨਾਪ ਦੱਸ ਦੂਗੇ ਜੀ ਨਾਪ ਤੁਹਾਨੂੰ ਕ ਸੂਟ ਏ ਚਾਹੀਦਾ ਕਿ ਤੁਸੀਂ ਉੱਦਾਂ ਹੀ ਲੈ ਲੂ ਲੈਂਥ ਲਿਖ ਲਉ ਚਾਲੀ ਘੇਰਾ ਲਿਖ ਲਉ ਛੱਬੀ ਜੀ ਤੀਰਾ ਸੱਤ ਜੀ ਹੈਗੀ ਗਿਆਰਾਂ ਕਮਰ ਤੇਈ ਠੀਕ ਹੈ ਜੀ ਬਾਹਾਂ ਮੇਰੀਆਂ ਜ਼ਿਆਦਾ ਲੰਬੀਆਂ ਨਾ ਰੱਖਿਉ ਜੀ ਜਲਦੀ ਦੇ ਦਿਉ ਜੀ ਬਣਾ ਦਿਉ ਮੈਨੂੰ ਚਾਹੀਦਾ ਜੀ ਬਸ ਸ਼ੁੱਕਰਵਾਰ ਤੱਕ